ਯੋਗਾ ਜੋ ਹੈ ਉਹ ਭਾਰਤ ਦੀ ਇੱਕ ਫੌਮ ਔਫ ਐਕਸਾਈਜ ਕਹੀ ਜਾ ਸਕਦੀ ਹੈ ਅਤੇ ਯੋਗਾ ਕਰਨ ਦੇ ਕਈ ਸਾਰੇ ਲਾਭ ਵੀ ਨੇ ਲੋਕਾਂ ਨੂੰ ਜੋ ਹੈ ਉਹ ਆਪਣੀ ਡੇਲੀ ਲਾਈਫ ਦੇ ਵਿੱਚ ਜੋ ਹੈ ਕੋਈ ਨਾ ਕੋਈ ਇੱਕ ਜਾਂ ਦੋ ਯੋਗਾ ਐਕਟੀਵਿਟੀਜ਼ ਜਿਵੇਂ ਕਿ ਸੂਰਯ ਨਮਸਕਾਰ ਜਾਂ ਫਿਰ ਕਪਾਲਭਾਤੀ ਇਵੇਂ ਦੀਆਂ ਐਕਟੀਵਿਟੀਜ਼ ਕਰਨੀਆਂ ਚਾਹੀਦੀਆਂ ਨੇ ਜਿਸ ਨਾਲ਼ ਉਹਨਾਂ ਦੀ ਜੋ ਬੌਡੀ ਹੈ ਉਹ ਫਿੱਟ ਰਹੇ ਯੋਗਾ ਜੋ ਹੈ ਇਸ ਨੂੰ ਇੰਟਰਨੈਸ਼ਨਲੀ ਵੀ ਡੋਕਟਰਸ ਨੇ ਕਿਹਾ ਹੈ ਕਿ ਫਿੱਟ ਰਹਿਣ ਲਈ ਰੋਜ਼ ਯੋਗਾ ਕਰਨਾ ਜੋ ਹੈ ਉਹ ਬਹੁਤ ਹੀ ਵਧੀਆ ਪ੍ਰੈਕਟਿਸ ਹੈ ਅਤੇ ਕੁੱਝ ਬਿਮਾਰੀਆਂ ਵੀ ਇਹੋ ਜਿਹੀਆਂ ਨੇ ਸਰੀਰਕ ਬਿਮਾਰੀਆਂ ਕਹਿ ਸਕਦੇ ਨੇ ਜਿਹਨਾਂ ਦਾ ਯੋਗਾ ਕਰਕੇ ਜੋ ਹੈ ਉਹ ਹੱਲ ਕੀਤਾ ਜਾ ਸਕਦਾ ਹੈ ਜੇਕਰ ਕੋਈ ਇਨਸਾਨ ਜੋ ਹੈ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਸਵੇਰੇ ਉੱਠ ਕੇ ਅੱਧਾ ਘੰਟਾ ਜਾਂ ਫਿਰ ਪੰਦਰ੍ਹਾਂ ਵੀਹ ਮਿੰਟ ਵੀ ਯੋਗਾ ਦੀ ਪ੍ਰੈਕਟਿਸ ਕਰੇ ਤਾਂ ਉਹ ਇਨਸਾਨ ਜੋ ਹੈ ਉਹ ਬਹੁਤ ਹੀ ਇੱਕ ਹੈਲਦੀ ਇਨਸਾਨ ਬਣ ਸਕਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿ ਸਕਦਾ